ਬਾਈਕਿੰਗ ਇੱਕ ਬਹੁਤ ਵਧੀਆ ਵਾਕਆਊਟ ਹੈ ਜੋ ਸਾਡੀ ਸਿਹਤ ਲਈ ਫਾਇਦੇਮੰਦ ਹੈ ਪਰ ਕਈ ਵਾਰ ਜਦੋਂ ਅਸੀਂ ਲੰਮੀ ਸੈਰ ਲਈ ਬਾਇਕਿੰਗ ਕਰਦੇ ਹਾਂ ਤਾਂ ਪਿੱਠ ਦਾ ਦਰਦ ਹੋ ਸਕਦਾ ਹੈ ਸਿਰਫ ਬਾਈਕਿੰਗ ਹੀ ਨਹੀਂ ਸਾਈਕਲਿੰਗ ਦੌਰਾਨ ਖਾਣਾ ਪੀਣਾ ਵੀ ਸਹੀ ਹੋਣਾ ਚਾਹੀਦਾ ਹੈ ਤਾਂ ਜੋ ਸਾਡੇ ਸਰੀਰ ਨੂੰ ਜ਼ਰੂਰੀ ਪੌਸ਼ਟਿਕਤਾ ਮਿਲ ਸਕੇ ਅਤੇ ਦਰਦ ਤੋਂ ਬਚਿਆ ਜਾ ਸਕੇ ਸਿਹਤਮੰਦ ਸਾਈਕਲਿੰਗ ਜਾਂ ਬਾਈਕਿੰਗ ਦੌਰਾਨ ਖਾਣਾ ਪੀਣ ਦੀ ਜ਼ਰੂਰਤ ਲੰਮੀ ਸੈਰ 'ਤੇ ਸਾਈਕਲਿੰਗ ਕਰਨ ਨਾਲ ਸਰੀਰ ਵਿੱਚ ਪਾਣੀ ਦੀ ਘਾਟ ਹੋ ਸਕਦੀ ਹੈ ਇਸ ਲਈ ਹਮੇਸ਼ਾ ਪਾਣੀ ਜਾਂ ਕੋਲਡ ਡਰਿੰਕ ਪੀਣਾ ਚਾਹੀਦਾ ਹੈ ਐਨਰਜੀ ਲਈ ਸਾਈਕਲਿੰਗ ਦੌਰਾਨ ਛੋਟੇ ਛੋਟੇ ਮੀਲਜ ਜਿਵੇਂ ਐਨਰਜੀ ਨਾਲ ਰਿਲੇਟਡ ਕੋਈ ਵੀ ਡਰਿੰਕ ਜਿਹੜੀ ਤੁਹਾਨੂੰ ਤੁਰੰਤ ਊਰਜਾ ਦਵੇ ਉਹ ਲੈਣੀ ਚਾਹੀਦੀ ਹੈ ਫਲ ਜਾਂ ਡਰਾਈ ਫਰੂਟਸ ਬਨਾਨਾ ਸੇਬ ਖਜੂਰ ਵਰਗੇ ਫਲਾਂ ਵਿੱਚ ਫਾਈਬਰ ਸ਼ੱਕਰ ਅਤੇ ਆਇਰਨ ਹੁੰਦਾ ਹੈ ਜੋ ਬਾਈਕਿੰਗ ਕਰਦਿਆਂ ਸਰੀਰ ਨੂੰ ਐਨਰਜੀ ਦਿੰਦੇ ਹਨ ਸਾਈਕਲਿੰਗ ਜਾਂ ਬਾਈਕਿੰਗ ਕਰਦੇ ਸਮੇਂ ਪਿੱਠ ਵਿੱਚ ਦਰਦ ਹੋ ਸਕਦਾ ਹੈ ਇਸ ਲਈ ਸਹੀ ਪੁਜੀਸ਼ਨ ਹੋਣੀ ਬਹੁਤ ਜ਼ਰੂਰੀ ਹੈ ਬਾਈਕਿੰਗ ਜਾਂ ਸਾਈਕਲਿੰਗ ਸੈਟਿੰਗ ਗਲਤ ਹੋਣ ਕਰਕੇ ਪਿੱਠ ਦਾ ਦਰਦ ਹੋ ਸਕਦਾ ਹੈ ਬੈਕ ਪੇਨ ਤੋਂ ਬਚਣ ਲਈ ਸਾਈਕਲ ਦੀ ਸੀਟ ਦੀ ਉੱਚਾਈ ਸਹੀ ਰੱਖੋ ਅਤੇ ਹਮੇਸ਼ਾ ਪਿੱਠ ਨੂੰ ਸਿੱਧਾ ਰੱਖ ਕੇ ਸਾਈਕਲ ਚਲਾਓ ਜੇ ਫਿਰ ਵੀ ਦਰਦ ਹੁੰਦਾ ਹੈ ਤਾਂ ਸਾਈਕਲਿੰਗ ਤੋਂ ਬਾਅਦ ਖਿੱਚ ਜਾਂ ਸਟਰ ਸਟਰਚਿੰਗ ਕਰਨਾ ਅਤੇ ਥੋੜ੍ਹੀ ਜਿਹੀ ਮਾਲਿਸ਼ ਕਰਨਾ ਫਾਇਦੇਮੰਦ ਹੁੰਦਾ ਹੈ ਸਾਈਕਲਿੰਗ ਦਰਦ ਦਾ ਅਨੁਭਵ ਇੱਕ ਵਾਰ ਮੈਂ ਪੰਜਾਹ ਕਿਲੋਮੀਟਰ ਦੀ ਸਾਈਕਲ ਰਾਈਡ 'ਤੇ ਗਿਆ ਸ਼ੁਰੂ ਵਿੱਚ ਸਭ ਕੁਝ ਠੀਕ ਸੀ ਪਰ ਜਿਵੇਂ ਹੀ ਦੂਜਾ ਹਿੱਸਾ ਸਫਰ ਦਾ ਸ਼ੁਰੂ ਹੋਇਆ ਮੇਰੀ ਪਿੱਠ ਵਿੱਚ ਦਰਦ ਮਹਿਸੂਸ ਹੋਣ ਲੱਗੀ ਇਸ ਦਾ ਕਾਰਨ ਸੀ ਮੇਰੀ ਸਾਈਕਲ ਦੀ ਸੀਟ ਥੋੜ੍ਹੀ ਜਿਹੀ ਉੱਚੀ ਸੀ ਜਿਸ ਕਰਕੇ ਮੇਰੀ ਪਿੱਠ ਨੂੰ ਵਾਧੂ ਬੋਝ ਝੱਲਣਾ ਪਿਆ ਇਸ ਤਜ਼ਰਬੇ ਤੋਂ ਮੈਨੂੰ ਸਿੱਖਿਆ ਮਿਲੀ ਕਿ ਸਾਈਕਲ ਦੀ ਸੀਟ ਦੀ ਸੈਟਿੰਗ ਸਹੀ ਹੋਣੀ ਜ਼ਰੂਰੀ ਹੈ